ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਪਠਾਣੀਆ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਜਿੱਦਾਂ ਕਿ ਇਹਨਾਂ ਦਾ ਪ੍ਰਸ਼ਨ ਹੈ ਕਿ ਸਿਹਤ ਦੇਖ ਰੇਖ ਸਮਾਜਿਕ ਸਹਾਇਤਾ ਅਤੇ ਸਨਮਾਨ ਦੇ ਰੂਪ ਵਿੱਚ ਪਠਾਨਕੋਟ ਜ਼ਿਲ੍ਹੇ ਵਿੱਚ ਬਜ਼ੁਰਗਵਾਦੀ ਦਾ ਸਾਹਮਣਾ ਕਰਣ ਵਾਲੀਆਂ ਮੁੱਖ ਚੁਣੌਤੀਆਂ ਅਤੇ ਮੌਕੇ ਕੀ ਹਨ ਅਗਰ ਮੈਂ ਇਸਦਾ ਜਵਾਬ ਦੇਵਾਂ ਤਾਂ ਜਿਸ ਤਰ੍ਹਾ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਬਜ਼ੁਰਗਵਾਦੀ ਦਾ ਸਾਹਮਣਾ ਕਿੱਦਾਂ ਹੋ ਸਕਦਾ ਹੈ ਜਿੱਦਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਜ਼ੁਰਗ ਲੋਕ ਇੱਕ ਮਹੱਤਵਪੂਰਨ ਜਨਸੰਖਿਆ ਤਬਦੀਲੀ ਵਿੱਚੋਂ ਗੁਜ਼ਰ ਰਹੇ ਹਨ ਜਿਉਂ ਜਿਉਂ ਆਬਾਦੀ ਵਧਦੀ ਹੈ ਅਤੇ ਉਮਰ ਵੱਧਦੀ ਹੈ ਦੇਸ਼ ਵਿੱਚ ਬਜ਼ੁਰਗਾਂ ਦੀ ਗਿਣਤੀ ਵੀ ਵੱਧਦੀ ਹੈ ਜਿੱਥੇ ਇਹ ਜਨਸੰਖਿਆ ਤਬਦੀਲੀ ਸਮਾਜ ਨੂੰ ਅਮੀਰ ਬਣਾਉਣ ਲਈ ਗਿਆਨ ਅਤੇ ਅਨੁਭਵ ਦੇ ਮੌਕੇ ਲਿਆਉਂਦੀ ਹੈ ਇਹ ਕਈ ਚੁਣੌਤੀਆਂ ਵੀ ਪੇਸ਼ ਕਰਦੀ ਹੈ ਇਹ ਲੇਖ ਭਾਰਤ ਵਿੱਚ ਬਜ਼ੁਰਗਾਂ ਦੀ ਵੱਧਦੀ ਆਬਾਦੀ ਉਹਨਾਂ ਨੂੰ ਦਰਪੇਸ਼ ਸਮੱਸਿਆਵਾਂ ਤਿਆਗ ਦੀ ਚਿੰਤਾਜਨਕ ਸਮੱਸਿਆ ਅਤੇ ਬਜ਼ੁਰਗਾਂ ਨੂੰ ਆਸਰਾ ਪੋਸ਼ਨ ਸੇਧ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰਕੇ ਉਹਨਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਬਾਰੇ ਚਰਚਾ ਕਰਦਾ ਹੈ ਜਿੱਦਾਂ ਕਿ ਕਾਫ਼ੀ ਐਨ ਜੀ ਓ ਵੀ ਖੁੱਲ੍ਹੇ ਹੋਏ ਹਨ ਜੋ ਜਿੱਦਾਂ ਕਿ ਬਰਿੱਧ ਆਸ਼ਰਮ ਹਨ ਧੰਨਵਾਦ